ਮੈਂ ਸ਼ਾਦੀ ਦੇ ਮੌਕੇ ਵਾਸਤੇ ਨਾ ਅਗਰ ਸੂਟ ਬਣਵਾਇਆ ਤਾਂ ਸਿਲਕ ਦੇ ਸੂਟ ਨੂੰ ਪਸੰਦ ਕਰਾਂਗੀ ਰੈਡ ਕਲਰ ਦਾ ਹੋਵੇ ਉਹਦੇ ਉੱਤੇ ਜ਼ਰੀ ਦਾ ਅਤੇ ਸੀਕੁਐਂਸ ਦਾ ਕੰਮ ਬਹੁਤ ਅੱਛਾ ਕੀਤਾ ਹੋਇਆ ਹੋਵੇ ਜਿਹਦੇ ਨਾਲ ਉਹਦਾ ਦੁਪੱਟਾ ਔਰਗੈਨਜਾ ਦਾ ਪਿਓਰ ਔਰਗੈਂਜਾ ਯੂਜ ਕੀਤਾ ਜਾਵੇ ਜਿਹਦੇ ਨਾਲ ਕੀ ਉਹਦੀ ਲੁਕ ਬਹੁਤ ਅੱਛੀ ਆਉਂਦੀ ਅਤੇ ਉਹ ਪਾਰਟੀ ਵੇਅਰ ਪਾਇਆ ਗਰੇਸਫੁਲ ਲੱਗਦਾ ਹਾਂਜੀ ਅਤੇ ਜ਼ਰੀਦਾਰ ਤੀਲੇ ਦਾ ਵਰਕ ਹੋਵੇਗਾ ਅਤੇ ਉਸ ਦੇ ਨਾਲ ਸ਼ਰਾਰਾ ਜਾਂ ਟਾਈਟ ਪੈਂਟ ਨੂੰ ਯੂਜ ਕੀਤਾ ਜਾਵੇਗਾ ਆ ਅਤੇ ਉਹਦੇ ਉੱਪਰ ਦੇ ਨਾਲ ਇਨਰ ਯੂਜ ਕਰਕੇ ਉਸ ਦੀ ਲੁੱਕ ਨੂੰ ਸੋਹਣਾ ਬਣਾਇਆ ਜਾ ਸਕਦਾ ਡੀਪ ਨੈਕ ਹਾਂਜੀ ਬਹੁਤ ਸੋਹਣੀ ਚੀਜ਼ ਤਿਆਰ ਹੋ ਸਕਦੀ ਹੈ ਉਸ ਤਰ੍ਹਾਂ ਹਾਂ ਉਹ ਜੋਰਜੱਟ ਵਿੱਚ ਵੀ ਮਿਲ ਸਕਦਾ ਅਤੇ ਸਿਲਕ 'ਚ ਵੀ ਮਿਲ ਸਕਦਾ ਉਹਦੇ ਦੁਪੱਟੇ ਦਾ ਕੰਮ ਦੇ ਨਾਲ ਟਸਲਸ ਜਾਂ ਕੋਈ ਲਟਕਣ ਵਗੈਰਾ ਯੂਜ ਕਰਕੇ ਦੁਪੱਟੇ ਨੂੰ ਵੀ ਸੋਹਣਾ ਬਣਾਇਆ ਜਾ ਸਕਦਾ ਹਾਂਜੀ ਥੈਂਕ ਯੂ